ਇੱਕ ਜਨਵਰੀ ਉੱਨੀ ਸੌ ਪੰਤਾਲ਼ੀ ਪੰਜ ਸਤੰਬਰ ਦੋ ਹਜ਼ਾਰ ਇੱਕ ਵੀਹ ਸਤੰਬਰ ਦੋ ਹਜ਼ਾਰ ਦੋ ਪੱਚੀ ਅਗਸਤ ਦੋ ਹਜ਼ਾਰ ਚਾਰ ਉਣੱਤੀ ਨਵੰਬਰ ਦੋ ਹਜ਼ਾਰ ਅੱਠ